ਸਤਿ ਸ਼੍ਰੀ ਅਕਾਲ ਸਰ ਮੈਂ ਹਰਸ਼ਪ੍ਰੀਤ ਦੀ ਮੰਮਾ ਬੋਲ ਰਹੀ ਹੈ ਨਾਈਨਥ ਕਲਾਸ 'ਚ ਪੜ੍ਹਦਾ ਅਤੇ ਸਾਡੇ ਕੋਲੋਂ ਸਰ ਮੀਟਿੰਗ 'ਤੇ ਆਇਆ ਨਹੀਂ ਗਿਆ ਅਤੇ ਮੈਂ ਉਹਦੇ ਮਾਰਕਸ ਬਾਰੇ ਪੁੱਛਣਾ ਚਾਹੁੰਦੀ ਸੀਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਹਮ ਹਮ ਠੀਕ ਹੈ ਜੀ

ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਹਾਂਜੀ ਹਾਂਜੀ ਕੋਈ ਨਾ ਮੈਂ ਕੋਸ਼ਿਸ਼ ਕਰੂੰਗੀ ਵੀ ਇਹ ਅੱਗੇ ਤੋਂ ਇੱਦਾਂ ਦੀ ਗਲਤੀ ਨਾ ਕਰੇ ਨਹੀਂ ਕਰਦਾ ਤਾਂ ਨਹੀਂ ਹੈ ਬਟ ਸ਼ਾਇਦ ਹੋ ਸਕਦਾ ਲਾਪਰਵਾਹੀ ਕਰ ਗਿਆ ਹੋਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਾ ਜੀ ਮੈਂ ਜ਼ਰੂਰ ਧਿਆਨ ਰੱਖੂ ਹਾਂਜੀ ਅਸੀਂ ਆਉਣਾ ਤਾਂ ਸੀ ਬਟ ਮਜ਼ਬੂਰੀ ਸੀ ਵੀ ਫੈਮਲੀ ਫੰਕਸ਼ਨ ਸੀਗਾ ਜਾਣਾ ਵੀ ਜ਼ਰੂਰੀ ਸੀਗਾ ਨਹੀਂ ਤਾਂ ਅਸੀਂ ਜ਼ਰੂਰ ਆਉਂਦੇ ਹਾਂਜੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਠੀਕ ਹੈ ਸਰ ਕੋਈ ਨਾ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਅਗਲੀ ਵਾਰ ਜ਼ਰੂਰ ਆਵਾਂਗੇ ਅਸੀਂ ਮੀਟਿੰਗ 'ਤੇ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ